ਮੈਂ ਪੰਜਾਬ ਦਾ ਰਹਿਣ ਵਾਲਾ ਹਾਂ ਪੁਰਾਣੇ ਸਮੇਂ ਦੇ ਵਿੱਚ ਲੋਕਾਂ ਨੂੰ ਸਿਹਤ ਬਾਰੇ ਕੁਝ ਜ਼ਿਆਦਾ ਚਾਨਣ ਨਹੀਂ ਹੁੰਦਾ ਸੀ ਅਗਰ ਘਰ ਕੋਈ ਬਿਮਾਰ ਹੁੰਦਾ ਸੀ ਤਾਂ ਲੋਕ ਘਰ ਦੇ ਨੁਸਖਿਆਂ ਦੇ ਨਾਲ ਹੀ ਪੁਰਾਣੇ ਬਜ਼ੁਰਗਾਂ ਦੇ ਦਿੱਤੇ ਨੁਸਖਿਆਂ ਦੇ ਨਾਲ ਹੀ ਕੀ ਹੈ ਠੀਕ ਹੋ ਜਾਂਦੇ ਸੀ ਪਤਾ ਹੀ ਨਹੀਂ ਚੱਲਦਾ ਸੀ ਬਿਮਾਰੀ ਹੋਈ ਕੀ ਹੈ ਅਤੇ ਬਿਮਾਰੀ ਠੀਕ ਕਦੋਂ ਹੋ ਗਈ ਲੇਕਿਨ ਜਿਵੇਂ ਜਿਵੇਂ ਸਮਾਂ ਪੈ ਰਿਹਾ ਹੈ ਉਵੇਂ ਉਵੇਂ ਕੀ ਹੈ ਜਿਹੜੀ ਸਹੂਲਤਾਂ ਨੇ ਉਹ ਵੱਧ ਗਈਆਂ ਅਤੇ ਬਿਮਾਰੀਆਂ ਦਾ ਪਤਾ ਵੀ ਜ਼ਿਆਦਾ ਲੱਗਣਾ ਸ਼ੁਰੂ ਹੋ ਗਿਆ ਵੀ ਹੁਣ ਕੀ ਹੈ ਜਦੋਂ ਵੀ ਕੋਈ ਬਿਮਾਰੀ ਹੁੰਦੀ ਹੈ ਤਾਂ ਡਾਕਟਰ ਕੋਲ ਜਾਂਦੇ ਹਾਂ ਘਰ ਦਾ ਇਲਾਜ ਨਹੀਂ ਕਰਦੇ ਘਰ ਦੇ ਨੁਸਖੇ ਨਹੀਂ ਵਰਤਦੇ ਡਾਕਟਰ ਕੋਲ ਜਾਂਦੇ ਹਾਂ ਡਾਕਟਰ ਸਾਨੂੰ ਉਹਦੇ ਪਹਿਲੇ ਕਹਿੰਦਾ ਟੈਸਟ ਕਰਵਾ ਕੇ ਆਓ ਜਦੋਂ ਟੈਸਟ ਕਰਵਾ ਕੇ ਆਉਂਦੇ ਹਾਂ ਤਾਂ ਟੈਸਟਾਂ ਦੇ ਵਿੱਚ ਆਉਂਦਾ ਤੁਹਾਨੂੰ ਆਹ ਬਿਮਾਰੀ ਹੈ ਅਤੇ ਡੋਕਟਰ ਫਿਰ ਉਹਦੇ ਬਾਰੇ ਹੋਰ ਨਵਾਂ ਟੈਸਟ ਲਿਖ ਦਿੰਦੇ ਨੇ ਜਿਹਦੇ ਨਾਲ ਕਿ ਬਿਮਾਰੀ ਹੋਰ ਜ਼ਿਆਦਾ ਵਧੀ ਲੱਗਣੀ ਸ਼ੁਰੂ ਹੋ ਜਾਂਦੀ ਹੈ ਸਹੂਲਤਾਂ ਤਾਂ ਵਧੀਆ ਲੇਕਿਨ ਸਹੂਲਤਾਂ ਦੇ ਨਾਲ ਡਰ ਵੀ ਕੀ ਹੈ ਜ਼ਿਆਦਾ ਵਧਣਾ ਸ਼ੁਰੂ ਹੋ ਗਿਆ ਡੋਕਟਰ ਨਵੀਆਂ ਨਵੀਆਂ ਬਿਮਾਰੀਆਂ ਉਹਦੇ ਨਾਲ ਸਾਨੂੰ ਨਵੀਆਂ ਨਵੀਆਂ ਦਵਾਈਆਂ ਦੇ ਦਿੰਦੇ ਨੇ ਜੀ ਹੁਣ ਕੀ ਹੋਇਆ ਹੈਗਾ ਜੀ ਲੇਕਿਨ ਪੰਜਾਬ ਦੇ ਵਿੱਚ ਕੀ ਇਹ ਸਹੂਲਤਾਂ ਕਾਫੀ ਵੱਧ ਗਈਆਂ ਲੋਕਾਂ ਨੂੰ ਨਵੇਂ ਨਵੇਂ ਇਹਨਾਂ ਦੇ ਸੈਮੀਨਾਰ ਲਗਾਏ ਜਾਂਦੇ ਨੇ ਨਵੇਂ ਨਵੇਂ ਕੈਂਪ ਲਗਾਏ ਜਾਂਦੇ ਨੇ ਲੋਕਾਂ ਨੂੰ ਸਿਹਤ ਸਹੂਲਤਾਂ ਬਾਰੇ ਜਾਣੂ ਕਰਵਾਇਆ ਜਾਂਦਾ ਹੈਗਾ ਆਪਣੇ ਪੰਜਾਬ ਦੇ ਵਿੱਚ ਏਮਸ ਖੁੱਲ੍ਹ ਗਿਆ ਏਮਸ ਇੱਕ ਬਹੁਤ ਵੱਡਾ ਹੋਸਪਿਟਲ ਹੈ ਜਿੱਥੇ ਲੋਕਾਂ ਨੂੰ ਦੂਰ ਜਾਣ ਦੀ ਬਜਾਏ ਆਪ ਦੇ ਨੇੜੇ ਹੀ ਇਲਾਜ ਮਿਲ ਜਾਂਦਾ ਹੈਗਾ ਲੁਧਿਆਣਾ ਦੇ ਵਿੱਚ ਅਪੋਲੋ ਹੋਸਪਿਟਲ ਹੈਗਾ ਲੋਕ ਉੱਥੇ ਜਾ ਕੇ ਆਪਦਾ ਇਲਾਜ ਕਰਵਾ ਲੈਂਦੇ ਹੈਗੇ ਨੇ ਪੰਜਾਬ ਦਾ ਸਭ ਤੋਂ ਵੱਡਾ ਹੋਸਪਿਟਲ ਪੀ ਜੀ ਆਈ ਹੈਗਾ ਪੀ ਜੀ ਆਈ ਦੇ ਵਿੱਚ ਹਰ ਤਰ੍ਹਾਂ ਦੇ ਡਾਕਟਰ ਦੇਸ਼ ਦੇ ਕੋਨੇ ਕੋਨੇ ਤੋਂ ਬੈਠ ਕੇ ਇਲਾਜ ਕਰਦੇ ਹੈਗੇ ਨੇ ਤੁਸੀਂ ਜਦੋਂ ਜਾਂਦੇ ਜੇ ਤੁਹਾਡੀ ਬਿਮਾਰੀ ਦੀ ਡੈੱਪਥ ਤੱਕ ਜਾਣੀ ਕਿ ਉਹਦੇ ਐਂਡ ਤੱਕ ਜਾਂਦੇ ਨੇ ਤੁਹਾਡੀ ਬਿਮਾਰੀ ਕਿੱਥੋਂ ਸ਼ੁਰੂ ਹੋਈ ਕਿਵੇਂ ਸ਼ੁਰੂ ਹੋਈ ਉਹਦਾ ਕੀ ਹੱਲ ਹੈ ਉਹਦੇ ਤੋਂ ਅੱਗੋਂ ਕੀ ਹੋ ਸਕਦਾ ਗਿਆ ਹਰ ਚੀਜ਼ ਦਾ ਸਲਊਸ਼ਨ ਉੱਥੇ ਮਿਲਦਾ ਤੁਹਾਡੀ ਬਿਮਾਰੀ ਪੂਰੀ ਪਕੜ 'ਚ ਆ ਜਾਂਦੀ ਹੈਗੀ ਹੈ ਤਾਂ ਲੋਕਾਂ ਨੂੰ ਕੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਜੋ ਟਾਈਮ ਚੱਲਦਾ ਹੈਗਾ ਸਾਨੂੰ ਜਿਹੜੀ ਸਾਡੀ ਜਿਹੜੀ ਹੈਲਥ ਫੈਸਿਲਿਟੀ ਹੈ ਜਾਂ ਸਾਡੀ ਸਿਹਤ ਫਸਿਲਟੀ ਹੈਗੀ ਹੈ ਉਹ ਬਹੁਤ ਜ਼ਿਆਦਾ ਕੀ ਸੁਧਰ ਕੇ ਸਾਹਮਣੇ ਆਈ ਹੈ